ਹੈਲੋ ਜੀ ਫਲਿੱਪਕਾਰਟ ਤੋਂ ਬੋਲ ਰਹੇ ਜੀ ਮੈਂ ਪਿਛਲੇ ਹਫ਼ਤੇ ਤੁਹਾਡੇ ਕੋਲ ਸ਼ਰਟ ਬੁੱਕ ਕੀਤੀ ਸੀ ਸ਼ਰਟ ਮੇਰੀ ਮੇਰੇ ਘਰ ਆ ਗਈ ਹੈ ਸ਼ਰਟ ਦਾ ਧਾਗੇ ਨਿਕਲ ਰਹੇ ਜੀ ਬਟਨ ਟੁੱਟ ਰਹੇ ਹੈ ਜੀ ਕਲਰ ਉੱਡ ਗਿਆ ਹੈ ਜੀ ਇਹ ਮੈਨੂੰ ਪਸੰਦ ਨਹੀਂ ਹੈਗੀ ਜੀ ਮੈਂ ਵਾਪਸ ਕਰ ਰਿਹਾਂ